ਅਸੀਂ ਸਾਡੇ ਬਾਗ ਵਿੱਚ ਉੱਗੇ ਹੋਏ ਫਲਾਂ ਦੀ ਵਰਤੋਂ ਆਪਣੀ ਅੱਛੀ ਸਿਹਤ ਲਈ ਸਿਹਤ ਸੰਭਾਲ ਲਈ ਕਰਦੇ ਹਾਂ ਜਿਵੇਂ ਕਿ ਸਾਡੇ ਬਗੀਚੇ ਵਿੱਚ ਅਮਰੂਦ ਅੰਬ ਅਤੇ ਚੀਕੂ ਹਨ ਅੰਬ ਦੀ ਵਰਤੋਂ ਅੱਛੀ ਸਿਹਤ ਲਈ ਕਰਦੇ ਹਾਂ ਅਸੀਂ ਅੰਬ ਦਾ ਅਚਾਰ ਵੀ ਬਣਾਉਂਦੇ ਹਾਂ ਅਤੇ ਇਸਦੀ ਚਟਣੀ ਦੀ ਵਰਤੋਂ ਕਰਦੇ ਹਾਂ ਇਸ ਤੋਂ ਇਲਾਵਾ ਸਾਡੇ ਬਗੀਚੇ ਵਿੱਚ ਕਈ ਤਰ੍ਹਾਂ ਦੇ ਫੁੱਲ ਹਨ ਜਿਹਨਾਂ ਦੀ ਵਰਤੋਂ ਸਾਡੇ ਬਗੀਚੇ ਨੂੰ ਚਾਰ ਚੰਦ ਲਾਉਂਦੀ ਹੈ ਸਾਡੇ ਬਗੀਚੇ ਵਿੱਚ ਗੁਲਾਬ ਗੇਂਦਾ ਮੋਤੀਆ ਅਤੇ ਹੋਰ ਭਿੰਨ ਭਿੰਨ ਤਰ੍ਹਾਂ ਦੇ ਫੁੱਲ ਹਨ ਅਸੀਂ ਗੁਲਾਬ ਦੇ ਫੁੱਲਾਂ ਨੂੰ ਅਤੇ ਗੇਂਦੇ ਫੁੱਲਾਂ ਨੂੰ ਗੁਲਦਸਤੇ ਦੇ ਰੂਪ ਵਿੱਚ ਵਰਤੋਂ ਕਰਦੇ ਹਾਂ ਬਹੁਤ ਸਾਰੀਆਂ ਅਗਨ ਲੋਕਨ ਹਾਲਾਂਕਿ ਇਹ ਚੰਗੀ ਤਰ੍ਹਾ ਕੀਤੇ ਗਏ ਕੰਮ ਲਈ ਮਹੱਤਵਪੂਰਨ ਹੈ ਜਿਹਦੇ ਵਿੱਚ ਅਸੀਂ ਫੁੱਲਾਂ ਨੂੰ ਦੇਖਦੇ ਹਾਂ ਤਾਂ ਇਹਨਾਂ ਨਾਲ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਅਸੀਂ ਇਹਨਾਂ ਫੁੱਲਾਂ ਤੋਂ ਜੋ ਇਹਨਾਂ ਦਾ ਰਾ ਮਟੀਰੀਅਲ ਹੁੰਦਾ ਹੈ ਉਸ ਤੋਂ ਘਰ ਲਈ ਇੱਕ ਅੱਛੀ ਧੂਪ ਵੀ ਤਿਆਰ ਕਰਦੇ ਹਾਂ ਅਤੇ ਫੁੱਲਾਂ ਦੀ ਮਾਲਾ ਅਸੀਂ ਭਗਵਾਨ ਨੂੰ ਭੇਟ ਕਰਦੇ ਹਾਂ ਅਤੇ ਪੂਜਾ ਲਈ ਵਰਤੋਂ ਕਰਦੇ ਹਾਂ